ਜੀ ਹਾਂ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਹਜੇ ਭੋਜਨ ਲਈ ਇੱਕ ਸ਼ੁੱਧ ਤੌਰ 'ਤੇ ਯਾਤਰਾ ਕੀਤੀ ਸਾਡੇ ਘਰ ਗੈਸਟ ਆਏ ਸੀ ਬਾਹਰੋਂ ਫੋਰਨ ਤੋਂ ਅਤੇ ਅਸੀਂ ਉਹਨਾਂ ਨਾਲ ਅਸੀਂ ਤਰਤਾਰਨ ਵਿੱਚ ਰਹਿੰਦੇ ਹਾਂ ਅਤੇ ਅਸੀਂ ਉਹਨਾਂ ਨਾਲ ਗਏ ਸੀ ਅੰਮ੍ਰਿਤਸਰ ਵਿਖੇ ਉੱਥੇ ਕੇਸਰ ਦੇ ਢਾਬੇ 'ਤੇ ਅਸੀਂ ਹਮੇਸ਼ਾ ਖਾਣਾ ਖਾਣ ਜਾਂਦੇ ਹਾਂ ਅਤੇ ਸਾਨੂੰ ਉਹਨਾਂ ਦਾ ਖਾਣਾ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਉਹਨਾਂ ਦਾ ਖਾਣਾ ਸ਼ੁੱਧ ਦੇਸੀ ਘਿਓ ਵਿੱਚ ਬਣਦਾ ਆ ਅਤੇ ਉਹਨਾਂ ਦੀ ਤਿਆਰੀ ਪ੍ਰੈਪਰੇਸ਼ਨ ਬਹੁਤ ਅੱਛੇ ਤਰੀਕੇ ਨਾਲ ਕਰਦੇ ਨੇ ਬਹੁਤ ਅੱਛੇ ਤਰੀਕੇ ਨਾਲ ਡੈਕੋਰੇਟ ਕਰਦੇ ਨੇ ਖਾਣਾ ਅੱਛੇ ਤਰੀਕੇ ਨਾਲ ਕਸਟਮਰਸ ਨਾਲ ਬਿਹੇਵ ਕਰਦੇ ਨੇ ਬਹੁਤ ਅੱਛੇ ਤਰੀਕੇ ਨਾਲ ਸਾਰਾ ਕੁਛ ਸਰਵ ਕਰਦੇ ਨੇ ਅਤੇ ਉਹਨਾਂ ਦੀਆਂ ਸਰਵਿਸਿਸ ਵੀ ਬਹੁਤ ਅੱਛੀਆਂ ਨੇ ਬਹੁਤ ਪਿਆਰ ਨਾਲ ਕਸਟਮਰ ਨਾਲ ਡੀਲ ਕਰਦੇ ਨੇ ਬੜਾ ਅੱਛੇ ਤਰੀਕੇ ਨਾਲ ਉਹਨਾਂ ਨੇ ਖਾਣਾ ਸਰਵ ਕੀਤਾ ਸਾਡੇ ਗੈਸਟ ਨੇ ਵੀ ਇੰਨਜੋਆਏ ਕੀਤਾ ਅਸੀਂ ਵੀ ਇੰਨਜੋਆਏ ਕੀਤਾ ਅਤੇ ਉਹਨਾਂ ਦਾ ਖਾਣਾ ਖਾ ਕੇ ਬਹੁਤ ਖੁਸ਼ ਹੋਏ ਸਾਡੇ ਗੈਸਟ ਵੀ ਫਿਰ ਅਸੀਂ ਉਹ ਖਾਣਾ ਇੰਨਜੋਆਏ ਕੀਤਾ ਅਤੇ ਉੱਥੋਂ ਆ ਗਏ